ਦਿੱਲੀ ਦੀਆਂ ਬੱਸਾਂ ਵਿੱਚ ਸਫਰ ਕਰਨਾ ਕਿੰਨਾ ਮੁਸ਼ਕਿਲ ਹੈ ਇਸ ਬਾਰੇ ਉਹੀ ਜਾਣਦਾ ਹੈ ਜਿਸਨੇ ਇਸ ਵਿੱਚ ਸਫਰ ਕੀਤਾ ਹੋਵੇ ਸਫਰ ਕਰਨ ਦਾ ਆਪਣਾ ਹੀ ਮਜ਼ਾ ਹੁੰਦਾ ਹੈ ਇਹੋ ਜਿਹਾ ਇੱਕ ਸਫਰ ਮੈਨੂੰ ਹਾਲੇ ਤੱਕ ਯਾਦ ਹੈ ਜਿਸ ਨੂੰ ਭੁਲਾ ਪਾਉਣਾ ਮੇਰੇ ਲਈ ਮੁਸ਼ਕਿਲ ਹੈ ਇੱਕ ਦਿਨ ਮੈਨੂੰ ਆਪਣੇ ਜ਼ਰੂਰੀ ਕੰਮ ਲਈ ਰੈਡ ਲਾਈਨ ਬੱਸ ਵਿੱਚ ਉੱਤਮ ਨਗਰ ਤੋਂ ਬਸ ਅੱਡੇ ਤੱਕ ਯਾਤਰਾ ਕਰਨੀ ਪੈ ਗਈ ਇਹ ਯਾਤਰਾ ਮੇਰੇ ਲਈ ਕਿਸ ਦ ਕਿਸ ਤਰ੍ਹਾਂ ਦੁਖਦਾਈ ਬਣ ਗਈ ਇਹ ਮੈਨੂੰ ਮੈਂ ਤੁਹਾਨੂੰ ਦੱਸਦਾ ਹਾਂ ਉਸ ਦਿਨ ਬੱਸ ਵਿੱਚ ਲਗਾਤਾਰ ਸਵਾਰੀਆਂ ਚੜ੍ਹ ਰਹੀਆਂ ਸਨ ਕੰਡਕਟਰ ਵਾਰ ਵਾਰ ਕਹਿ ਰਿਹਾ ਸੀ ਬਸ ਹੁਣੇ ਚੱਲ ਪਵੇਗੀ ਪਰੰਤੂ ਬੱਸ ਚੱਲਣ ਦਾ ਨਾਮ ਹੀ ਨਹੀਂ ਲੈ ਰਹੀ ਸੀ ਵੀਹ ਮਿੰਟ ਬਾਅਦ ਬੱਸ ਚੱਲ ਪਈ ਪਰ ਉਸਨੇ ਸਮੇਂ ਤੱਕ ਬਸ ਖੱਚਾ ਖੱਚ ਭਰ ਚੁੱਕੀ ਸੀ ਬੱਸ ਵਿੱਚ ਭੀੜ ਹੋਣ ਕਰਕੇ ਮੈਨੂੰ ਸੀਟ ਨਹੀਂ ਮਿਲੀ ਮੈਨੂੰ ਛੱਤ ਦਾ ਝੰਡਾ ਫੜ ਕੇ ਯਾਤਰਾ ਕਰਨੀ ਪਈ ਪਿੱਛੇ ਦੇ ਲੋਕ ਅੱਗੇ ਧੱਕਾ ਮਾਰਦੇ ਹੋਏ ਅੱਗੇ ਨਿਕਲ ਗਏ